ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਹਾਂ ਹਾਂਜੀ ਹਾਂਜੀ ਭਾਅ ਜੀ ਤਰਨਤਾਰਨ ਦੇ ਵਿੱਚ ਬਹੁਤ ਏ ਸਾਰੀਆਂ ਜਗ੍ਹਾ ਘੁੰਮਣ ਲਈ ਜਿਵੇਂ ਆਪਣਾ ਦਰਬਾਰ ਸਾਹਿਬ ਹੋ ਗਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਵਰਲਡ ਦਾ ਸਭ ਤੋਂ ਵੱਡਾ ਸਰੋਵਰ ਇੱਥੇ ਹੀ ਆ ਦਰਬਾਰ ਸਾਹਿਬ ਆਪਣੇ ਤਰਨ ਹਾਂਜੀ ਅਤੇ ਹੁਣ ਆਪਣੇ ਬੀਬੀ ਭਾਨੀ ਜੀ ਦਾ ਮੇਲਾ ਵੀ ਆਉਣ ਵਾਲਾ ਉੱਥੇ ਵੀ ਤੁਸੀਂ ਜਾ ਸਕਦੇ ਜੇ ਦੋ ਫੈਬ ਨੂੰ

ਭਾਅ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਬੀਬੀ ਭਾਨੀ ਜੀ ਦਾ ਨਗਰ ਕੀਰਤਨ ਵੀ ਹੈ ਅਠਾਈ ਤਰੀਕ ਨੂੰ ਹਾਂਜੀ ਤੁਸੀਂ ਉੱਥੇ ਜਾ ਸਕ ਗੋਇੰਦਵਾਲ ਭਾਅ ਜੀ ਉਹ ਵੀ ਤਰਨਤਾਰਨ ਤੋਂ ਹੋ ਕੇ ਜਾਣੀ ਆ ਉਹ ਜੰਡਿਆਲਾ ਜੰਡਿਆਲੇ ਥਾਣੀ ਜਾਈਦਾ ਉੱਥੋਂ ਭਾਅ ਜੀ ਹਾਂਜੀ ਗੋਇੰਦਵਾਲ ਸਾਹਿਬ ਜਾਂਦੀ ਬੱਸ ਹਾਂਜੀ ਟਰੈਵਲ ਵੀ ਵਧੀਆ ਆਟੋ ਵੀ ਵਧੀਆ ਵਾ ਜੇ ਤੁਸੀਂ ਲੋਕਲ ਸ਼ਹਿਰ ਹਾਂਜੀ ਜੇ ਤੁਸੀਂ ਲੋਕਲ ਸ਼ਹਿਰ 'ਚ ਜਾਣਾ ਉਹ ਵੀ ਆ ਤੁਹਾਨੂੰ ਆਟੋ ਮਿਲ ਜਾਂਦਾ ਵਾ ਜੇ ਤੁਸੀਂ ਜਿੱਦਾਂ ਅੰਮ੍ਰਿਤਸਰ ਆਉਣਾ ਹੋਵੇ ਜਾਂ ਗੋਇੰਦਵਾਲ ਸਾਹਿਬ ਜਾਣਾ ਹੋਵੇ ਬਰਗਰ ਕਿੰਗ ਹੈਗਾ ਆਪਣੇ ਇੱਥੇ ਕੈਫੇਜ਼ ਹੈਗੇ ਬੜੇ ਤਰਨਤਾਰਨ ਹਾਂਜੀ ਖੁੱਲ੍ਹਾ ਖਾਣ ਪੀਣ ਵੱਲੋਂ ਆਪਾਂ ਨੂੰ ਜਦ ਹਾਂਜੀ ਹਾਂਜੀ ਠੀਕ ਥੈਂਕ ਯੂ